ਹੈਲੋ ਸਤਿ ਸ਼੍ਰੀ ਅਕਾਲ ਮੈਂ ਔਨਲਾਈਨ ਤੁਹਾਡੇ ਸਟੋਰ ਤੋਂ ਇੱਕ ਕੁੜਤੀ ਮੰਗਵਾਈ ਸੀ ਮੈਂ ਇਹ ਗੱਲ ਤੋਂ ਬਹੁਤ ਖੁਸ਼ ਹਾਂ ਵੀ ਜਿੰਨੇ ਦਿਨ ਦੀ ਡਿਲੀਵਰੀ ਦਾ ਤੁਸੀਂ ਕਿਹਾ ਸੀ ਭੇਜਣ ਦਾ ਉੱਨੇ ਦਿਨਾਂ ਦੇ ਵਿੱਚ ਹੀ ਤੁਸੀਂ ਜਿਹੜੀ ਡਿਲੀਵਰੀ ਹੈ ਉਹ ਭੇਜੀ ਹੈ ਤੁਹਾਡੀ ਪੈਕਿੰਗ ਵੀ ਬਹੁਤ ਜ਼ਿਆਦਾ ਵਧੀਆ ਸੀਗੀ ਔਰ ਤੁਹਾਡਾ ਜਿਹੜਾ ਮੈਟੀਰੀਅਲ ਹੈ ਜਿਵੇਂ ਦਾ ਤੁਸੀਂ ਦਿਖਾਇਆ ਸੀ ਔਨਲਾਈਨ ਦਿਖਾਇਆ ਮੈਟੀਰੀਅਲ ਵੀ ਰੰਗ ਵੀ ਬਹੁਤ ਹੀ ਵਧੀਆ ਜਿਹੜਾ ਕੁੜਤੀ ਦਾ ਨਿਕਲਿਆ ਕੁੜਤੀ ਦੀ ਜਿਹੜੀ ਫੀਟਿੰਗ ਹੈ ਉਸ ਬਾਰੇ ਮੇਰੇ ਕੋਲ ਬਿਆਨ ਕਰਨ ਦੇ ਲਈ ਸ਼ਬਦ ਹੀ ਨਹੀਂ ਕੁੜਤੀ 'ਤੇ ਕੀਤੀ ਗਈ ਉਬਰਾਈ ਐਮਬਰਾਈਡਰੀ ਕਢਾਈ ਦੇ ਲਈ ਸਾਰੇ ਜਣਿਆਂ ਨੇ ਜਿੰਨੀਆਂ ਨੇ ਵੀ ਦੇਖਿਆ ਓਨਿਆਂ ਨੇ ਸਿਫਤ ਕੀਤੀ ਮੈਨੂੰ ਲੱਗਦਾ ਹੈ ਵੀ ਇਸ ਔਨਲਾਈਨ ਜਿਹੜਾ ਮੈਂ ਕੁੜਤੀ ਖਰੀਦੀ ਹੈ ਜਿੰਨੇ ਦੀ ਮੈਂ ਖਰੀਦੀ ਆ ਉਸ ਤੋਂ ਵੱਧ ਦੀ ਜਿਹੜੀ ਸਿਫਤ ਹੈ ਲੋਕਾਂ ਤੋਂ ਮੈਂ ਉਹ ਸੁਣ ਚੁੱਕੀ ਹਾਂ ਮੈਨੂੰ ਜਿਹੜਾ ਤੁਹਾਡਾ ਪ੍ਰੋਡਕਟ ਹੈ ਅਤੇ ਤੁਹਾਡਾ ਡਿਲੀਵਰੀ ਦਾ ਟਾਈਮ ਹੈ ਇਹ ਸਾਰਾ ਕੁਛ ਮੈਨੂੰ ਬਹੁਤ ਪਸੰਦ ਆਇਆ ਧੰਨਵਾਦ